ਪਿੰਡਾਂ ਵਿੱਚ ਜੇਕਰ ਕੋਈ ਕਿਸੇ ਦੀ ਲੜਾਈ ਹੋ ਜਾਵੇ ਅਤੇ ਕੋਈ ਅੰਗ ਟੁੱਟ ਜਾਵੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਪਿੰਡਾਂ 'ਚ ਜਿੱਥੋਂ ਤੱਕ ਹੋ ਸਕੇ ਸਾਨੂੰ ਬਾਂਸ ਦੀਆਂ ਫੱਟੀਆਂ ਜਾਂ ਪੱਟੀ ਦੇ ਸਹਾਰੇ ਨਾਲ ਜਿਹੜਾ ਅੰਗ ਟੁੱਟਾ ਹੁੰਦਾ ਜਿਵੇਂ ਲੱਤ ਜਾਂ ਬਾਂਹ ਉਹਨੂੰ ਬੰਨ੍ਹਣਾ ਚਾਹੀਦਾ ਬੰਨ੍ਹਣ ਤੋਂ ਬਾਅਦ ਉਹਦਾ ਵੇਖਣਾ ਚਾਹੀਦਾ ਕੋਈ ਬਾਹਰੀ ਜ਼ਖਮ ਤਾਂ ਨਹੀਂ ਹੈਗਾ ਖੂਨ ਤਾਂ ਨਹੀਂ ਵਗ ਰਿਹਾ ਜੇ ਖੂਨ ਵਗ ਰਿਹਾ ਤਾਂ ਉਹਨੂੰ ਵੀ ਘੁੱਟ ਕੇ ਪੱਟੀ ਬੰਨ੍ਹ ਦੇਣੀ ਚਾਹੀਦੀ ਆ ਫਿਰ ਆਪਾਂ ਕਿਸੇ ਚੰਗੇ ਹਸਪਤਾਲ ਦੀ ਐਂਬੂਲੈਂਸ ਬੁਲਾ ਕੇ ਅਤੇ ਉਸੇ ਹਸਪਤਾਲ ਦੇ ਵਿੱਚ ਖੜ੍ਹਨਾ ਚਾਹੀਦਾ ਮਰੀਜ਼ ਨੂੰ ਖੜ੍ਹਨ ਤੋਂ ਬਾਅਦ ਉਹਦਾ ਐਕਸਰੇ ਹੋਣਾ ਚਾਹੀਦਾ ਫਿਰ ਡਾਕਟਰ ਜਿਹੜਾ ਉਹ ਦੇਖ ਰੇਖ ਦੇ ਵਿੱਚ ਆਪਣਾ ਪਲਸਤਰ ਵਗੈਰਾ ਲਗਾ ਕੇ ਅਤੇ ਉਹਨਾਂ ਨੂੰ ਸਹੀ ਕਰਕੇ ਬੰਨ੍ਹਦਾ ਫਿਰ ਜਦੋਂ ਘਰ ਦੇ ਵਿੱਚ ਛੁੱਟੀ ਮਿਲੇਗੀ ਹਸਪਤਾਲ ਦੇ ਵਿੱਚੋਂ ਡਾਕਟਰ ਉਹਨੂੰ ਮਰੀਜ਼ ਨੂੰ ਅਤੇ ਉਹਦੇ ਨਾਲ ਉਹਨੂੰ ਕੋਈ ਐਂਟੀਬਾਇਓਟਿਕ ਦਵਾਈਆਂ ਜਿਵੇਂ ਮੌਕਸਿਸਲੀਨ ਵਗੈਰਾ ਦੇ ਇੰਜੈਕਸ਼ਨ ਲਗਾਉਣੇ ਚਾਹੀਦੇ ਆ ਜਾਂ ਦਰਦ ਰੋਕਣ ਵਾਲੀਆਂ ਦਵਾਈਆਂ ਦੇਣੀਆਂ ਚਾਹੀਦੀਆਂ ਦਵਾਈਆਂ ਖਾਣ ਦੇ ਨਾਲ ਮਰੀਜ਼ ਰੈਸਟ ਰੱਖੇ ਅਤੇ ਉਹਦਾ ਜਿਹੜਾ ਇਲਾਜ ਆ ਉਹ ਛੇਤੀ ਹੋ ਸਕਦਾ